ਉਣੱਤੀ ਅਪ੍ਰੈਲ ਉੱਨੀ ਸੌ ਉਣਾਸੀ ਵੀਹ ਅਗਸਤ ਦੋ ਹਜ਼ਾਰ ਚਾਰ ਨੌ ਦਸੰਬਰ ਦੋ ਹਜ਼ਾਰ ਛੇ ਉਣੱਤੀ ਫਰਵਰੀ ਉੱਨੀ ਸੌ ਬਿਆਸੀ ਬਾਰ੍ਹਾਂ ਮਈ ਉੱਨੀ ਸੌ ਨੱਬੇ